ਹਾਂਜੀ ਕਿਤਾਬਾਂ ਨੂੰ ਪੜ੍ਹਨਾ ਜਾਂ ਫਿਰ ਕਿਸੇ ਵੀ ਚੀਜ਼ ਨੂੰ ਲੈ ਕੇ ਜਦੋਂ ਉਹਦੇ ਦੁਆਰਾ ਇੱਕ ਸਾਨੂੰ ਮੈਨਿਊ ਮਿਲਦਾ ਉਹਨੂੰ ਮੈਂ ਪੜ੍ਹਦੀ ਹੈ ਪ੍ਰੋਪਰ ਪਸੰਦ ਹੈ ਮੈਨੂੰ ਕਿਤਾਬਾਂ ਪੜ੍ਹਨੀਆਂ ਜਾਂ ਉਹਨਾਂ ਸਾਰਿਆਂ ਬਾਰੇ ਪੜ੍ਹਨਾ ਆਡੀਓ ਬੁੱਕਸ ਔਡੀਬਲਸ ਐਪ ਵੀ ਕਾਫ਼ੀ ਸਾਰੀਆਂ ਹੈਗੀਆਂ ਜਿਨ੍ਹਾਂ ਤੋਂ ਮੈਂ ਕਹਾਣੀਆਂ ਵਗੈਰਾ ਸੁਣੀਆਂ ਜਿਵੇਂ ਕਿ ਸਪੋਟੀ ਜਾਂ ਫਿਰ ਇੰਗਲਿਸ਼ ਲਰਨਿੰਗ ਦੀਆਂ ਵੀ ਕੁਛ ਐਪਸ ਹੈਗੀਆਂ ਜਿਹੜੀਆਂ ਮੈਂ ਡਾਊਨਲੋਡਸ ਕੀਤੀਆਂ ਫ਼ੋਨ 'ਚ ਉਹਨਾਂ ਤੋਂ ਇੰਗਲਿਸ਼ ਵਗੈਰਾ ਸਿੱਖੀ ਹੈ ਕਿ ਕਿਵੇਂ ਉਹਨੂੰ ਪਰਨਾਊਂਸ ਕਰਨਾ ਅਲੱਗ ਅਲੱਗ ਡਿਫਰੈਂਟ ਡਿਫਰੈਂਟ ਵਰਡਸ ਨੂੰ ਤਾਂ ਉਹ ਸਾਰਾ ਮੈਂ ਅਕਸਰ ਕਰਦੀ ਰਹਿੰਦੀ ਹਾਂ